ਸਰਕਾਰ ਦੁਆਰਾ ਜੋ ਮੁਹਿੰਮ ਚਲਾਈ ਜਾ ਰਹੀ ਹੈ ਘਰ ਘਰ ਪਾਣੀ ਮਿਲੇ ਦੋ ਹਜ਼ਾਰ ਤੇਈ ਦੀ ਇਹ ਸਕੀਮ ਮਹਿਜ਼ ਜਿਸ ਵਿੱਚ ਸਰਕਾਰ ਨੇ ਸਾਨੂੰ ਘਰ ਘਰ ਵਿੱਚ ਪਾਣੀ ਦੀ ਸੁਵਿਧਾ ਦਿੱਤੀ ਹੈ ਸਾਨੂੰ ਪਹਿਲਾਂ ਪਾਣੀ ਦੀ ਦਿੱਕਤ ਆਉਂਦੀ ਸੀਗੀ ਸਾਨੂੰ ਦੂਰੋਂ ਲੈ ਕੇ ਆਉਣਾ ਪੈਂਦਾ ਸੀਗਾ ਜਾਂ ਪਾਣੀ ਗੰਧਲਾ ਸੀਗਾ ਸਾਫ ਨਹੀਂ ਹੁੰਦਾ ਸੀਗਾ ਹੁਣ ਟੂਟੀਆਂ ਰਾਹੀਂ ਸਾਨੂੰ ਸਾਫ ਪਾਣੀ ਦੀ ਸੁਵਿਧਾ ਮਿਲੀ ਹੈ ਜਿਸ ਦੇ ਨਾਲ ਸਾਡੇ ਲੋਕ ਸਿਹਤਮੰਦ ਹੋਏ ਆ ਪਹਿਲਾਂ ਸਾਨੂੰ ਦਿੱਕਤ ਰਹਿੰਦੀ ਸੀਗੀ ਪਾਣੀ ਬੜਾ ਗੰਧਲਾ ਹੁੰਦਾ ਸੀਗਾ ਖਰਾਬ ਪਾਣੀ ਆਉਂਦਾ ਸੀਗਾ ਜਿਸ ਦੇ ਕਾਰਨ ਲੋਕ ਜ਼ਿਆਦਾਤਰ ਬਿਮਾਰ ਰਹਿੰਦੇ ਸੀਗੇ ਹੁਣ ਟੂਟੀ ਰਾਹੀਂ ਜਿਹੜਾ ਪਾਣੀ ਆ ਰਿਹਾ ਉਹ ਆਰ ਓ ਦਾ ਪਾਣੀ ਆ ਸਾਫ ਸੁਥਰਾ ਪਾਣੀ ਆ ਜਿਸ ਦੇ ਨਾਲ ਲੋਕ ਸਿਹਤਮੰਦ ਹਨ ਅਤੇ ਸਾਫ ਪਾਣੀ ਦੀ ਜੋ ਸਰਕਾਰ ਨੇ ਟੀਚਾ ਮਿਥਿਆ ਸੀਗਾ ਕਿ ਦੋ ਹਜ਼ਾਰ ਤੇਈ ਤੱਕ ਅਸੀਂ ਘਰ ਘਰ ਪਾਣੀ ਪਹੁੰਚਾਵਾਂਗੇ ਟੂਟੀਆਂ ਰਾਹੀਂ ਉਹ ਉਸ ਦੇ ਵਿੱਚ ਉਹ ਸਫਲ ਹੋਏ